ਹਾਂਜੀ ਸਾਡੇ ਖੇਤਰ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਖੇਡਣ ਵਾਲੇ ਗਰਾਊਂਡਾਂ ਦੀ ਘਾਟ ਹੈ ਜਿਸ ਕਾਰਨ ਬਹੁਤ ਸਾਰੇ ਪਲੇਅਰ ਗੇਮਾਂ ਖੇਡਣ ਵਿੱਚ ਵਾਂਝੇ ਰਹਿ ਜਾਂਦੇ ਹਨ ਸੋ ਜੇਕਰ ਸਰਕਾਰ ਇਹਨਾਂ ਮੁਸ਼ਕਿਲਾਂ ਨੂੰ ਹੱਲ ਕਰ ਦਿਤ ਕਰ ਦਵ ਦਿਤ ਦਵੇ ਤਾਂ ਬਹੁਤ ਸਾਰੇ ਹੋਣਹਾਰ ਪਲੇਅਰ ਪੈਦਾ ਹੋ ਸਕਦੇ ਹਨ